ਯੋਗਾ ਕਰਨਾ ਸਾਡੇ ਲਈ ਬਹੁਤ ਹੀ ਇੱਕ ਅਸ਼ੁੱਧੀ ਜਿਹੀ ਇੱਕ ਦਵਾਈ ਆ ਜਾਂ ਮੈਡੀਸਨ ਲਾ ਲਓ ਕੁਛ ਵੀ ਲਾ ਲਓ ਯੋਗਾ ਇੱਕ ਬਹੁਤ ਹੀ ਵਧੀਆ ਚੀਜ਼ ਹੈ ਜੇਕਰ ਸਾਡੇ ਬੱਚੇ ਛੋਟੀ ਹੀ ਉਮਰ ਵਿੱਚ ਯੋਗਾ ਕਰਨ ਲੱਗ ਜਾਣਗੇ ਤਾਂ ਇਸ ਦੇ ਬਹੁਤ ਜ਼ਿਆਦਾ ਫਾਇਦੇ ਹਨ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਜੇ ਆਪਾਂ ਯੋਗਾ ਤੋਂ ਸਟਾਰਟ ਕਰਵਾ ਦੇਵਾਂਗੇ ਤਾਂ ਬੱਚਾ ਵੱਡੀ ਉਮਰ ਤੱਕ ਬਹੁਤ ਹੀ ਫਿਟ ਰਹਿੰਦਾ ਹੈ ਬੱਚੇ ਦਾ ਮਾਇੰਡ ਫਿਟਨੈਸ ਰਹਿੰਦਾ ਬੱਚੇ ਦਾ ਸਰੀਰ ਫਿੱਟ ਰਹਿੰਦਾ ਮਾਇੰਡ ਫਰੈਸ਼ ਰਹਿੰਦਾ ਬੱਚਾ ਸਟੱਡੀ ਵਿੱਚ ਤੇਜ਼ ਹੁੰਦਾ ਬੱਚੇ ਦੀ ਬੋਡੀ ਫਿਟ ਰਹਿੰਦੀ ਹੈ ਬੱਚੇ ਨੂੰ ਯੋਗਾ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ ਯੋਗਾ ਦੀ ਆਦਤ ਛੋਟੀ ਉਮਰ ਤੋਂ ਹੀ ਲਗਾਵਾਂਗੇ ਤਾਂ ਵੱਡੀ ਉਮਰ ਤੱਕ ਸਾਡਾ ਆਪਣਾ ਆਪ ਹੀ ਰੂਟੀਨ ਬਣ ਜਾਂਦਾ ਰੋਜ਼ਾਨਾ ਯੋਗਾ ਦਾ ਜੇਕਰ ਅਸੀਂ ਯੋਗਾ ਕਰਦੇ ਹਾਂ ਤਾਂ ਅਸੀਂ ਕਾਫੀ ਬਿਮਾਰੀਆਂ ਤੋਂ ਰਾਹਤ ਪਾਉਂਦੇ ਹਾਂ ਸਾਨੂੰ ਮੈਡੀਸਨ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਅਸੀਂ ਯੋਗਾ ਕਰਦੇ ਹਾਂ ਤਾਂ ਬੱਚੇ ਯੋਗਾ ਜੋ ਬੱਚੇ ਯੋਗਾ ਕਰਦੇ ਆ ਬੱਚੇ ਬੜੇ ਹੀ ਖੁਸ਼ ਰਹਿੰਦੇ ਆ ਬੱਚਿਆਂ ਦਾ ਮਾਇੰਡ ਫਰੈਸ਼ ਰਹਿੰਦਾ ਬੱਚੇ ਬੜੀ ਜਲਦੀ ਜਲਦੀ ਆਪਣਾ ਕੰਮ ਕੰਪਲੀਟ ਕਰਦੇ ਆ ਬੱਚੇ ਵੈਸੇ ਹੀ ਬਾਡੀ ਤੋਂ ਵੀ ਫਿੱਟ ਰਹਿੰਦੇ ਆ ਬੱਚਿਆਂ ਨੂੰ ਬਿਮਾਰੀਆਂ ਘੇਰਾ ਨਹੀਂ ਪਾਉਂਦੀਆਂ ਹੈਗੀਆਂ ਬੱਚੇ ਸਟਡੀ ਵਿੱਚ ਵੀ ਤੇਜ਼ ਹੁੰਦੇ ਆ ਬੱਚੇ ਵੈਸੇ ਐਕਟਿਵ ਰਹਿਣ ਲੱਗ ਜਾਂਦੇ ਆ ਇਸ ਕਰਕੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਯੋਗਾ ਦੀ ਆਦਤ ਪਾਉਣੀ ਚਾਹੀਦੀ ਹੈ ਯੋਗਾ ਇੱਕ ਬਹੁਤ ਹੀ ਵਧੀਆ ਚੀਜ਼ ਹੈ ਯੋਗਾ ਕਰਨ ਦੇ ਨਾਲ ਸਾਨੂੰ ਮੈਡੀਸਨ ਤਾਂ ਦਿਖਦੀ ਨਹੀਂ ਮੈਡੀਸਨ ਕਾਫੀ ਹੱਦ ਤੱਕ ਸਾਡੀ ਮੈਡੀਸਨ ਜੇ ਸਾਡੀ ਕੋਈ ਗੰਭੀਰ ਬਿਮਾਰੀ ਦੀ ਮੈਡੀਸਨ ਚੱਲ ਵੀ ਰਹੀ ਆ ਉਹ ਵੀ ਛੁੱਟ ਜਾਂਦੀ ਹੈ ਕਾਫੀ ਲੋਕਾਂ ਦਾ ਯੋਗਾ ਕਰਨ ਨਾਲ ਸ਼ੂਗਰ ਬਿਲਕੁਲ ਨੋਰਮਲ ਹੋ ਚੁੱਕਿਆ ਹਾਰਟ ਦੇ ਪੇਸ਼ੈਂਟ ਠੀਕ ਹੋ ਚੁੱਕੇ ਹੈ ਬਿਮਾਰੀਆਂ ਹੱਡੀਆਂ ਦੀਆਂ ਬਿਮਾਰੀਆਂ ਗੋਡਿਆਂ ਦੀਆਂ ਬਿਮਾਰੀਆਂ ਕਾਫੀ ਸਟੇਜਾਂ ਤੋਂ ਸਾਨੂੰ ਯੋਗਾ ਕਰਨ ਨਾਲ ਰਾਹਤ ਮਿਲਦੀ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਯੋਗਾ ਦੀ ਆਦਤ ਪਾਉਣੀ ਸ਼ੁਰੂ ਕਰੋ